ਮੇਰੀ ਗਾਉਣ ਮੇਰੀ ਗਾਉਣ ਦੀ ਰੁਚੀ ਸਭ ਤੋਂ ਪਹਿਲਾਂ ਸੌਲ੍ਹਾਂ ਸਾਲ ਦੀ ਉਮਰ ਵਿੱਚ ਪੈਦਾ ਹੋਈ ਮੇਰੀ ਗਾਉਣ ਦੀ ਰੁਚੀ ਦਾ ਮੁੱਖ ਕਾਰਨ ਡੇਰਾ ਸੱਚਾ ਸੌਦਾ ਹੈ ਮੈਂ ਡੇਰਾ ਸੱਚਾ ਸੌਦਾ ਤੋਂ ਨਾਮ ਸ਼ਬਦ ਲਿਆ ਸੀ ਸਾਡੇ ਪਿੰਡ ਵਿੱਚ ਨਾਮ ਚਰਚਾ ਲੱਗਦੀ ਹੁੰਦੀ ਸੀ ਜਿਸ ਨੂੰ ਕਿ ਸੰਗਤ ਕਹਿੰਦੇ ਹਨ ਉਹ ਸੰਗਤ ਵਿੱਚ ਜਦੋਂ ਮੈਂ ਵੇਖਦਾ ਸੀ ਅਤੇ ਕਿ ਵੀ ਦੂਸਰੇ ਮੇਰੇ ਚਾਚਾ ਚਾਚਾ ਜੀ ਅਤੇ ਹੋਰ ਮੇਰੇ ਦੋਸਤ ਸ਼ਬਦ ਲਗਾਉਂਦੇ ਹੁੰਦੇ ਸਨ ਜਿਸ ਨੂੰ ਕਿ ਭਜਨ ਕਹਿੰਦੇ ਹਨ ਵੀ ਉਹ ਭਜਨ ਗਾਉਂਦੇ ਹੁੰਦੇ ਸਨ ਤਾਂ ਮੈਨੂੰ ਵੀ ਇੰਝ ਲੱਗਦਾ ਹੁੰਦਾ ਸੀ ਮੈਂ ਵੀ ਗਾਵਾਂ ਇਸ ਲਈ ਮੈਂ ਉਸ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਮੈਂ ਕਵਾਲੀਆਂ ਭਜਨ ਸ਼ਬਦ ਲਗਾਉਂਦਾ ਹੁੰਦਾ ਸੀ ਇਸ ਦੇ ਨਾਲ ਹੀ ਮੈਨੂੰ ਗਾਉਣ ਦੀ ਮੇਰੀ ਰੁਚੀ ਵਿੱਚ ਹੋਰ ਵਾਧਾ ਹੁੰਦਾ ਗਿਆ ਹੌਲੀ ਹੌਲੀ ਮੈਂ ਸਕੂਲ ਕਾਲਜਾਂ ਦੇ ਫੰਕਸ਼ਨਾਂ ਵਿੱਚ ਗਾਉਣ ਲੱਗ ਪਿਆ ਅਤੇ ਮੈਂ ਲਗਭਗ ਵੀਹ ਸਾਲ ਦੇ ਵਿੱਚ ਉਮਰ ਵਿੱਚ ਆਪਣੀ ਗਾਉਣ ਦੀ ਪ੍ਰਤੀਭਾ ਖੋਜ ਲਈ ਇੱਕ ਵਧੀਆ ਕਲਾਕਾਰ ਬਣ ਗਿਆ ਇਸ ਦੇ ਨਾਲ ਹੀ ਮੈਂ ਹੁਣ ਵੱਡੇ ਵੱਡੇ ਸਟੇਜ ਪਰਫੋਰਮੈਂਸ ਸਮਾਗਮਾਂ ਵਿੱਚ ਆਪਣਾ ਯੋਗਦਾਨ ਪਾ ਰਿਹਾ ਹਾਂ